ਜੇਕਰ ਮੈਨੂੰ ਮੇਰੀ ਜ਼ਿੰਦਗੀ ਵਿੱਚ ਕਿਸੇ ਵੀ ਵੱਖਰੇ ਦੇਸ਼ ਦੀ ਯਾਤਰਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਹ ਦੇਸ਼ ਆਸਟ੍ਰੇਲੀਆ ਹੋਵੇਗਾ ਕਿਉਂਕਿ ਮੈਂ ਆਪਣੀ ਅੱਗੇ ਦੀ ਪੜ੍ਹਾਈ ਆਸਟ੍ਰੇਲੀਆ ਵਿੱਚ ਕਰਨਾ ਚਾਹੁੰਦੀ ਹਾਂ ਇਸ ਲਈ ਮੈਂ ਹੁਣ ਅੰਗਰੇਜ਼ੀ ਦੀਆਂ ਕਲਾਸਾਂ ਲੈ ਰਹੀ ਹਾਂ ਤਾਂ ਕਿ ਮੈਨੂੰ ਉੱਥੇ ਜਾ ਕੇ ਕੋਈ ਮੁਸ਼ਕਿਲ ਨਾ ਆਵੇ ਕਿ ਮੈਂ ਕਿਸੇ ਨਾਲ ਗੱਲਬਾਤ ਨਾ ਕਰ ਸਕਾਂ ਅਤੇ ਆਪਣੀ ਪੜ੍ਹਾਈ ਨਾ ਕਰ ਸਕਾਂ ਇਸ ਲਈ ਮੈਂ ਸਮਝਦੀ ਹਾਂ ਕਿ ਅੰਗਰੇਜ਼ੀ ਬਹੁਤ ਹੀ ਜ਼ਰੂਰੀ ਹੈ ਅਗਰ ਕਿਸੇ ਨੇ ਕਿਸੇ ਵੱਖਰੇ ਦੇਸ਼ ਜਾ ਕੇ ਪੜ੍ਹਾਈ ਕਰਨੀ ਹੈ ਮੁੱਖ ਤੌਰ 'ਤੇ ਕਿਸੇ ਵੀ ਯੂਨਾਈਟਿਡ ਸਟੇਟ ਦੇ ਵਿੱਚ ਇਸ ਲਈ ਆਸਟ੍ਰੇਲੀਆ ਹੀ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਮੈਂ ਜਾ ਕੇ ਪੜ੍ਹਾਈ ਕਰਨੀ ਚਾਹੁੰਦੀ ਹਾਂ